ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕੀ ਹਾਲ ਚਾਲ ਹੈ ਭਾਅ ਜੀ ਤੁਸੀਂ ਸੋਨਪਾਲੈਂਟ ਤੋਂ ਬੋਲ ਰਹੇ ਹੋ ਮੈਂ ਭਾਅ ਜੀ ਥੋੜ੍ਹੇ ਦਿਨ ਪਹਿਲਾਂ ਤੁਹਾਡੀ ਸ਼ੋਪ ਤੋਂ ਇੱਕ ਮੋਬਾਈਲ ਔਡਰ ਕੀਤਾ ਸੀ ਇੱਕ ਤਾਂ ਭਾਅ ਜੀ ਮੈਨੂੰ ਡਿਲੀਵਰੀ ਬੜੀ ਲੇਟ ਮਿਲੀ ਆ ਫ਼ੋਨ ਦੀ ਅਤੇ ਤੁਹਾਡਾ ਜੋ ਡਿਲੀਵਰੀ ਵਾਲਾ ਬੰਦਾ ਸੀ ਉਹਦਾ ਵਿਵਹਾਰ ਵੀ ਜ਼ਿਆਦਾ ਚੰਗਾ ਨਹੀਂ ਸੀ ਜਦੋਂ ਮੈਂ ਡੱਬਾ ਖੋਲ੍ਹਿਆ ਤਾਂ ਮੈਨੂੰ ਪਹਿਲਾਂ ਪ ਉਹਦੇ 'ਤੇ ਧੂੜ ਬਹੁਤ ਜੰਮੀ ਹੋਈ ਦਿਖੀ ਲੱਭੀ ਜਦੋਂ ਉਸ ਤੋਂ ਬਾਅਦ ਮੈਂ ਫ਼ੋਨ ਖੋਲ੍ਹਿਆ ਅਤੇ ਉਸ 'ਤੇ ਸਕਰੀਨ 'ਤੇ ਬ ਬਹੁਤ ਜ਼ਿਆਦਾ ਸਕਰੈਚ ਪਏ ਹੋਏ ਸੀ ਉਹਦਾ ਗਲਾਸ ਕਾਰਡ ਵੀ ਟੁੱਟਿਆ ਹੋਇਆ ਸੀ ਅਤੇ ਜਦੋਂ ਮੈਂ ਫ਼ੋਨ ਚਲਾ ਕੇ ਦੇਖਿਆ ਤਾਂ ਉਹ ਹੈਂਗ ਵੀ ਬਹੁਤ ਜ਼ਿਆਦਾ ਹੁੰਦਾ ਸੀ ਉਹਦੀ ਸਪੀਕਰ ਕੁਆਲਿਟੀ ਵੀ ਬਹੁਤ ਘੱਟ ਸੀ ਅਤੇ ਉਹਦਾ ਕੈਮਰਾ ਵੀ ਬਹੁਤ ਜ਼ਿਆਦਾ ਮਤਲਬ ਕੁਆਲਿਟੀ ਬਹੁਤ ਜ਼ਿਆਦਾ ਘੱਟ ਸੀ ਭਾਅ ਜੀ ਇਸਦੀ ਬੈਟਰੀ ਦੀ ਕਪੈਸਟੀ ਵੀ ਬਹੁਤ ਜ਼ਿਆਦਾ ਘੱਟ ਸੀ ਇਹ ਜ਼ਿਆਦਾ ਟਾਈਮ ਨਹੀਂ ਕੱਢਦਾ ਅਤੇ ਥੋ ਦੋ ਥੋੜ੍ਹੇ ਟਾਈਮ 'ਚ ਹੀ ਡੈਡ ਹੋ ਜਾਂਦਾ ਹੈ ਮੈਂ ਭਾਅ ਜੀ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਜਾਂ ਤਾਂ ਤੁਸੀਂ ਮੈਨੂੰ ਸੈਮਸੰਗ ਦਾ ਕੋਈ ਹੋਰ ਫ਼ੋਨ ਦਿਓ ਅਤੇ ਜਾਂ ਤਾਂ ਇਸਦੇ ਬਦਲੇ ਮੈਨੂੰ ਹੋਰ ਕੋਈ ਹੋਰ ਚੀਜ਼ ਦਿੱਤੀ ਜਾਵੇ ਇਹਦਾ ਭਾਅ ਜੀ ਦੱਸ ਦਿਓ ਕੀ ਪ੍ਰੋਸੀਜ਼ਰ ਹੈ ਅਤੇ ਜਦੋਂ ਮੈਂ ਤੁਹਾਡੀ ਸ਼ੋਪ 'ਤੇ ਦੁਬਾਰਾ ਆਉਂਗਾ ਅਤੇ ਕੋਈ ਦੂਜਾ ਅਤੇ ਕੋਈ ਹੋਰ ਮੋਬਾਈਲ ਲੈ ਕੇ ਜਾਊਂਗਾ ਠੀਕ ਹੈ ਭਾਅ ਜੀ ਧੰਨਵਾਦ